ਅੱਜ ਭਾਰਤ ਦੇ ਸਾਹਮਣੇ ਵਾਤਾਵਰਨ ਸਬੰਧੀ ਸਭ ਤੋਂ ਵੱਡੇ ਮੁੱਦੇ ਹਨ ਹਵਾ ਦਾ ਦੂਸ਼ਿਤ ਹੋਣਾ ਪਾਣੀ ਦਾ ਪ੍ਰਦੂਸ਼ਣ ਵੱਧ ਜਾਣਾ ਅਤੇ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਨਾਲ ਜਿਹੜੇ ਆ ਸਿਹਤ 'ਤੇ ਇਫੈਕਟ ਪੈਂਦਾ ਵਾ ਜਿੱਦਾਂ ਹੁਣ ਦੇਖ ਲਓ ਤੁਸੀਂ ਕਿ ਹੁਣ ਹਵਾ ਪ੍ਰਦੂਸ਼ਿਤ ਹੁੰਦੀ ਪਈ ਆ ਹੁਣ ਆਪਣੇ ਡਿਵੈਲਪਮੈਂਟ ਹੁੰਦੀ ਜਾ ਰਹੀ ਆ ਹੈ ਨਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਦੁਨੀਆਂ ਵੱਧ ਰਹੀ ਆ ਹੁਣ ਉਹਦੇ ਨਾਲ ਕੀ ਉਹਨਾਂ ਦੀਆਂ ਲੋੜਾਂ ਵੀ ਵੱਧ ਰਹੀਆਂ ਨੇ ਜਿਹਦੇ ਅਕੋਰਡਿੰਗ ਹੁਣ ਹਰ ਇੱਕ ਚੀਜ਼ ਦੇ ਲਈ ਫੈਕਟਰੀ ਜਿਸ ਤਰ੍ਹਾਂ ਖੁੱਲੀਆਂ ਹੋਈਆਂ ਨੇ ਹਰ ਇੱਕ ਜਿਹੜਾ ਵਾ ਜਾਂ ਸ਼ਹਿ ਪਹਿਲਾਂ ਸ਼ਹਿਰਾਂ ਵਿੱਚ ਸੀਗੀਆਂ ਹੁਣ ਪਿੰਡਾਂ 'ਚ ਵੀ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹਦੇ ਨਾਲ ਜਿਹੜਾ ਉਹਦੇ ਵਿੱਚ ਕੈਮੀਕਲ ਜਿਹੜੇ ਨਿਕਲਦੇ ਨੇ ਅਤੇ ਜਿਹੜਾ ਉਹਦਾ ਧੂੰਆਂ ਵਾ ਜਿਸ ਤਰ੍ਹਾਂ ਹੁਣ ਲੈ ਲਓ ਕਿ ਹਵਾ ਪ੍ਰਦੂਸ਼ਿਤ ਹੁੰਦੀ ਆ ਜਿਹੜਾ ਫੈਕਟਰੀਆਂ ਦੇ ਵਿੱਚ ਨਿਕਲਦਾ ਹੋਇਆ ਧੂੰਆਂ ਵਾ ਕੈਮੀਕਲ ਆ ਜਿਹੜੇ ਉਹ ਹਵਾ ਨੂੰ ਜਿਹੜੇ ਪ੍ਰਦੂਸ਼ਿਤ ਕਰ ਦਿੰਦੇ ਨੇ ਅਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਹਵਾ ਦਾ ਜਿਹੜਾ ਪੂਰਾ ਵਾਯੂਮੰਡਲ ਆ ਉਹ ਸਾਰੇ ਵਿੱਚ ਕੈਮੀਕਲ ਜਦੋਂ ਮਿਕਸ ਹੋ ਜਾਂਦੇ ਨੇ ਅਤੇ ਉਹ ਜਦੋਂ ਆਪਾਂ ਹੁਣ ਆਕਸੀਜਨ ਜਿਹੜੀ ਲੈਂਦੇ ਹਾਂ ਅਤੇ ਉਹਦੇ 'ਚ ਕੀ ਆ ਕਿ ਜਿਹੜਾ ਮਨੁੱਖੀ ਜਿਹੜੀ ਜੀਵਨ ਨੂੰ ਜਿਹੜਾ ਪ੍ਰਭਾਵਿਤ ਕਰਦੀਆਂ ਨੇ ਉਹਦੇ ਨਾਲ ਉਹਨਾਂ ਨੂੰ ਜਿਹੜੇ ਕੈਂਸਰ ਵਰਗੀਆਂ ਇਹੋ ਜਿਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਸਕਿਨ ਦੇ ਬਹੁਤ ਸਾਰੇ ਮਤਲਬ ਸਰੀਰਕ ਜਿਹੜੇ ਰੋਗ ਉਹਨਾਂ ਨੂੰ ਲੱਗਦੇ ਨੇ ਕਿ ਜਿਨ੍ਹਾਂ ਦਾ ਕਈ ਵਾਰ ਇਹੋ ਜਿਹੀ ਕੰਡੀਸ਼ਨ ਉਹਨਾਂ ਦੀ ਹੋ ਜਾਂਦੀ ਹੈ ਕਿ ਉਹ ਇਹਨਾਂ ਨੂੰ ਮੈਨੇਜ ਨਹੀਂ ਕਰ ਪਾਉਂਦੇ ਅਤੇ ਉਹਨਾਂ ਦੀ ਜਿਹੜੀ ਆ ਡੈਥ ਤੱਕ ਦੀ ਕੰਡੀਸ਼ਨ ਬਣ ਜਾਂਦੀ ਆ ਉਹਦੇ ਨਾਲ ਨਾਲ ਜਿਹੜਾ ਵਾ ਹੁਣ ਪਾਣੀ ਦਾ ਹੀ ਲੈ ਲਓ ਤੁਸੀਂ ਕਿਸ ਤਰ੍ਹਾਂ ਹੁਣ ਫੈਕਟਰੀਸ ਹੀ ਹੈ ਫੈਕਟਰੀ 'ਚ ਜਿਹੜੇ ਕੈਮੀਕਲ ਨਿਕਲਦੇ ਨੇ ਉਹ ਕੀ ਕਰਦੇ ਨੇ ਕਿ ਪਾਣੀ ਦੇ ਵਿੱਚ ਹੀ ਵਗਾ ਦਿੰਦੇ ਨੇ ਨਦੀਆਂ ਦੇ ਪਾਣੀ ਜਿਹੜੇ ਉਹ ਦੂਸ਼ਿਤ ਹੁੰਦੇ ਜਾ ਰਹੇ ਨੇ ਜਿਹਦੇ ਨਾਲ ਕਿ ਉਹ ਪਸ਼ੂ ਇਸ ਤਰ੍ਹਾਂ ਜਾ ਕੇ ਪਾਣੀ ਪੀਂਦੇ ਪਿੰਡਾਂ ਥਾਵਾਂ ਦੇ ਵਿੱਚ ਤਾਂ ਪਾਣੀ ਉਹ ਹੀ ਜਾਵੇਗਾ ਅਤੇ ਉਹ ਪਾਣੀ ਪੀਣ ਦੇ ਨਾਲ ਜਿਹੜਾ ਕੀ ਹੋਵੇਗਾ ਪਸ਼ੂਆਂ ਦੀ ਹਾਲਤ 'ਤੇ ਵੀ ਜਿਹੜਾ ਵਾ ਉਹ ਇਫੈਕਟ ਪਾਵੇਗੀ ਅਤੇ ਉਹ ਪਾਣੀ ਜਿਹੜਾ ਆਪਣੇ ਖੇਤਾਂ ਵਿੱਚ ਜਾ ਕੇ ਉਹ ਜਿਸ ਤਰ੍ਹਾਂ ਆਪਾਂ ਦੇਵਾਂਗੇ ਖੇਤਾਂ ਨੂੰ ਪਾਣੀ ਕਿ ਉੱਥੇ ਜਾ ਕੇ ਵੀ ਉਹਦਾ ਗਰੋਥ ਨੂੰ ਇਫੈਕਟ ਕਰੇਗਾ ਇਹਦੇ ਨਾਲ ਕੀ ਹੈ ਐਗਰੀਕਲਚਰ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ ਅਤੇ ਜਿਹੜਾ ਨਾਲ ਜਾਨਵਰਾਂ ਨੂੰ ਜਿਹੜਾ ਨੁਕਸਾਨ ਹੋਣਾ ਹੀ ਆ ਅਤੇ ਕਈ ਤਾਂ ਇਹੋ ਜਿਹੇ ਏਰੀਆਸ ਨੇ ਹੈਗੇ ਨੇ ਆਪਣੇ ਪੰਜਾਬ ਦੇ ਵਿੱਚ ਕਿ ਜਿੱਥੇ ਕਿ ਪਾਣੀ ਦਾ ਸੋਰਸ ਹੀ ਜਿਹੜਾ ਨਦੀਆਂ ਨੇ ਅਤੇ ਜੇ ਸੋਚੋ ਕਿ ਫੈਕਟਰੀ 'ਚ ਨਿਕਲਦੇ ਹੋਏ ਜਿਹੜੇ ਕੈਮੀਕਲ ਆ ਜਿਹੜੇ ਪਾਣੀ ਦੇ ਵਿੱਚ ਅ ਮਿਕਸ ਹੋ ਜਾਣਗੇ ਅਤੇ ਜੇ ਲੋਕ ਉਹ ਪਾਣੀ ਪੀਣਗੇ ਤਾਂ ਉਹਨਾਂ ਨੂੰ ਤਾਂ ਬਿਮਾਰੀਆਂ ਤਾਂ ਲੱਗਣੀਆਂ ਹੀ ਆ ਜਿਹਦੇ ਨਾਲ ਉਹਨਾਂ ਨੂੰ ਤਾਂ ਡੈਥ ਤੱਕ ਹੋ ਸਕਦੀ ਹੈ ਅਤੇ ਅੱਜ ਕੱਲ੍ਹ ਚਾਹੀਦਾ ਵਾ ਕਿ ਵੱਧ ਤੋਂ ਵੱਧ ਜਿਹੜੇ ਲੋਕ ਜਾਗਰੂਕ ਹੋਣ ਅਤੇ ਜਾਂ ਚਾਹੀਦਾ ਵਾ ਕਿ ਅ ਇੰਨੀ ਡਿਵੈਲਪਮੈਂਟ ਹੋ ਜਾਵੇ ਕਿ ਹਰ ਕੋਈ ਜਿਹੜਾ ਵਾ ਪਾਣੀ ਦਾ ਜਿਹੜਾ ਸੋਰਸ ਆ ਉਹ ਜਿਹੜਾ ਵਾ ਗੁੱਡ ਕੁਆਲਿਟੀ ਦਾ ਜਿਹੜਾ ਪਾਣੀ ਜਿਹੜਾ ਉਹਨਾਂ ਨੂੰ ਮਿਲੇ ਅਤੇ ਇਹਦੇ ਨਾਲ ਨਾਲ ਜਿਹੜਾ ਵਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਡਿਵੈਲਪਮੈਂਟ ਹੁੰਦੀ ਜਾ ਰਹੀ ਆ ਅਤੇ ਜਿਹੜੇ ਜਿਹੜਾ ਖੇਤਰ ਆ ਦੇਖੋ ਸੜਕਾਂ ਪੱਕੀਆਂ ਹੋ ਰਹੀਆਂ ਨੇ ਉਹਦੇ ਨਾਲ ਕੀ ਆ ਰੁੱਖ ਵੱਢੇ ਜਾ ਰਹੇ ਨੇ ਅਤੇ ਰੁੱਖਾਂ ਦੇ ਜਿਹੜੇ ਲਗਾਤਾਰ ਜਿਹੜੀ ਆ ਕਟਾਈ ਹੋ ਰਹੀ ਆ ਅਤੇ ਨਵੇਂ ਰੁੱਖ ਉਗਾ ਨਹੀਂ ਰਹੇ ਉਹਦੇ ਨਾਲ ਵੀ ਕੀ ਹੈ ਕਿ ਧਰਤੀ ਦੇ ਵਿੱਚ ਜਿਹੜਾ ਤਾਪਮਾਨ ਉਹ ਵੱਧਦਾ ਜਾ ਰਿਹਾ ਹੈ ਇਹਦੇ ਕਾਰਨ ਜਿਹੜਾ ਮੌਸਮ 'ਚ ਵੀ ਤਬਦੀਲੀ ਹੁੰਦੀ ਪਈ ਹੈ ਗਰਮੀ ਵੱਧ ਰਹੀ ਹੈ ਅਤੇ ਸਰਦੀ ਦਿਨੋ ਦਿਨ ਘੱਟ ਰਹੀ ਆ ਪਹਿਲੇ ਜ਼ਮਾਨੇ 'ਚ ਹੁੰਦਾ ਸੀਗਾ ਕਿ ਬਹੁਤ ਸਰਦੀ ਪੈਂਦੀ ਸੀਗੀ ਆਪਾਂ ਨੂੰ ਸੁੰਨ ਪੈਂਦਾ ਸੀਗਾ ਪਰ ਹੁਣ ਜਿਹੜਾ ਇਹ ਸਭ ਕੁਝ ਘਟ ਰਿਹਾ ਹੈ